ਮੈਂ ਭੁਪਿੰਦਰ ਸਿੰਘ ਤੁਹਾਡੇ ਨਾਲ ਆਪਣੀ ਕਸ਼ਮੀਰੀ ਯਾਤਰਾ ਦਾ ਸਫਰ ਸਾਂਝਾ ਕਰਨਾ ਚਾਹੁੰਦਾ ਹਾਂ ਸਭ ਤੋਂ ਪਹਿਲਾਂ ਜਿਹੜਾ ਸਾਡੇ ਲਈ ਵਧੀਆ ਰਿਹਾ ਉਹ ਸੀ ਸਾਡਾ ਸਫਰ ਬੱਸ ਦੇ ਵਿੱਚ ਸਫਰ ਕਰਨਾ ਬਹੁਤ ਹੀ ਰਮਾਨਦਾਇਕ ਅਤੇ ਸੁਹਾਵਣਾ ਸੀ ਜਿਸ ਦੇ ਵਿੱਚ ਸਾਨੂੰ ਆਸੇ ਪਾਸੇ ਦਾ ਦ੍ਰਿਸ਼ ਦਿਖਦਾ ਸੀ ਤੇ ਉਸ ਦ੍ਰਿਸ਼ ਵਿੱਚ ਦਿਖ ਰਹੀ ਹਰਿਆਲੀ ਪੰਛੀ ਅਤੇ ਪਹਾੜ ਬਹੁਤ ਹੀ ਸੁਹਾਵਣੇ ਸਨ ਤੇ ਇਸ ਤੋਂ ਬਾਅਦ ਜਦੋਂ ਅਸੀਂ ਉੱਥੇ ਉਤਰੇ ਤੇ ਉੱਥੋਂ ਦੇ ਪਹਾੜ ਉੱਥੇ ਦਾ ਮੌਸਮ ਠੰਡੀ ਹਵਾ ਤੇ ਬਰਫ ਬਹੁਤ ਹੀ ਸੁਹਾਵਣੀ ਸੀ ਤੇ ਇਸ ਦੇ ਨਾਲ ਨਾਲ ਹੀ ਜਿਹੜਾ ਸਭ ਤੋਂ ਵਧੀਆ ਉੱਥੋਂ ਦਾ ਸੀਗਾ ਉਹ ਸੀਗਾ ਖਾਣ ਪੀਣ ਖਾਣ ਪੀਣ ਦੇ ਵਿੱਚ ਠੰਡੇ ਮਾਹੌਲ ਦੇ ਵਿੱਚ ਜੇਕਰ ਕੁਝ ਗਰਮ ਖਾਣ ਨੂੰ ਮਿਲਦਾ ਹੈ ਤੇ ਉਹ ਬਹੁਤ ਹੀ ਵਧੀਆ ਲੱਗਦਾ ਹੈ ਉਸ ਤੋਂ ਬਾਅਦ ਉੱਥੋਂ ਦਾ ਰੈਂਟ ਜਿਹੜਾ ਸੀਗਾ ਬਹੁਤ ਘੱਟ ਸੀ ਤੇ ਖਾਣ ਪੀਣ ਦੇ ਪੈਸੇ ਵੀ ਬਹੁਤ ਘੱਟ ਸੀਗੇ ਉਸ ਤੋਂ ਬਾਅਦ ਜਦੋਂ ਆਪਾਂ ਕਸ਼ਮੀਰ ਘੁੰਮਣ ਗਏ ਪਹਾੜਾ ਤੇ ਘੁੰਮਣ ਗਏ ਤੇ ਉੱਥੋਂ ਦੀ ਹਰਿਆਲੀ ਉੱਥੋਂ ਦੇ ਪੰਛੀ ਉੱਥੋਂ ਦਾ ਮੌਸਮ ਵੀ ਬਹੁਤ ਸੁਹਾਵਣਾ ਸੀ ਤੇ ਝੀਲਾਂ ਵੀ ਬਹੁਤ ਸੁੰਦਰ ਸਨ ਝੀਲਾਂ ਦੇ ਵਿੱਚ ਚੱਲ ਰਹੀਆਂ ਵੋਟਾਂ ਦੇ ਦੁਆਲੇ ਉਸਦੇ ਫੁੱਲ ਬਾਗ ਬਗੀਚੇ ਆਦੀ ਵੇਖਣ ਨੂੰ ਬਹੁਤ ਹੀ ਸੁੰਦਰ ਲੱਗਦੇ ਸਨ ਇਸ ਦੇ ਨਾਲ ਨਾਲ ਆਪਾਂ ਉੱਥੇ ਵੋਟਿੰਗ ਵੀ ਕੀਤੀ ਵੋਟਿੰਗ ਦੇ ਚਾਰਜਿਸ ਜਿਹੜੇ ਉਹ ਬਹੁਤ ਹੀ ਘੱਟ ਸੀ ਇਸ ਦੇ ਨਾਲ ਨਾਲ ਆਪਾਂ ਫਿਰ ਕਸ਼ਮੀਰੀ ਯਾਤਰਾ ਤੇ ਮੁੜਨ ਦੌਰਾਨ ਉੱਥੋਂ ਦੇ ਇੱਕ ਫੇਮਮ ਪਕਵਾਨ ਟਰਾਏ ਕੀਤੇ ਜਿਹੜੇ ਬਹੁਤ ਹੀ ਸਵਾਦਿਸ਼ਟ ਸਨ ਤੇ ਉਹਨਾਂ ਦਾ ਜਿਹੜਾ ਰੈਂਟ ਉਹ ਵੀ ਬਹੁਤ ਸਹੀ ਸੀ ਕਸ਼ਮੀਰ ਘੁੰਮਣ ਨੂੰ ਬਹੁਤ ਹੀ ਸੋਹਣੀ ਜਗ੍ਹਾ ਹੈ ਮੈਂ ਚਾਹੁੰਦਾ ਹਾਂ ਕੀ ਮੈਂ ਉੱਥੇ ਦੁਬਾਰਾ ਇੱਕ ਵਾਰ ਫਿਰ ਜਾਵਾ ਤੇ ਉੱਥੋਂ ਦੇ ਪਹਾੜ ਪੰਛੀ ਦ੍ਰਿਸ਼ ਰੁੱਖਾਂ ਨੂੰ ਫਿਰ ਅਨੁਭਵ ਕਰਾ